ਹਾਂਜੀ ਮੇਰੇ ਕੋਲ ਓਦਾਂ ਬਹੁਤ ਸਾਰੀਆਂ ਕਿਤਾਬਾਂ ਹਨ ਪਰ ਮੇਰੀ ਮਨਪਸੰਦ ਕਿਤਾਬ ਜਪੁਜੀ ਸਾਹਿਬ ਦੀ ਬਾਣੀ ਹੈ ਬਾਣੀ ਪੜ੍ਹਨ ਦਾ ਕੋਈ ਟਾਈਮ ਨਹੀਂ ਹੁੰਦਾ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਬਾਣੀ ਅੰਮ੍ਰਿਤੁ ਸਾਰੇ ਵਿੱਚ ਬਾਣੀ ਅੰਮ੍ਰਿਤੁ ਸਾਰੇ ਬਾਣੀ ਅੰਮ੍ਰਿਤ ਹੈ ਬਾਣੀ ਪੜ੍ਹਨ ਦਾ ਸਭ ਤੋਂ ਵਧੀਆ ਸਮਾਂ ਅੰਮ੍ਰਿਤ ਵੇਲਾ ਹੈ ਬਾਣੀ ਅੰਮ੍ਰਿਤ ਵੇਲੇ ਪੜ੍ਹਨ ਨਾਲ ਵਰਤਦੀਆਂ ਹਨ ਕੋਈ ਬੁਰੀ ਸ਼ਕਤੀ ਹੈ ਤਾਂ ਉਸ ਦਾ ਨਾਸ਼ ਹੋ ਜਾਂਦਾ ਹੈ ਸਿਹਤ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਹ ਵੀ ਬਾਣੀ ਪੜ੍ਹ ਕੇ ਠੀਕ ਹੋ ਜਾਂਦੀ ਹੈ ਕਿਸੇ ਵੀ ਤਰਾਂ ਦੀ ਕੋਈ ਅਧਿਆਤਮਕ ਜਾਂ ਦੁਨਿਆਵੀ ਸਮੱਸਿਆ ਦਾ ਹੱਲ ਹੈ ਬਾਣੀ ਬਾਣੀ ਧੁਰ ਦਰਗਾਹ ਤੋਂ ਆਈ ਹੈ ਬਾਣੀ ਵਰਤਦੀ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਗੁਰੂ ਹੈ ਬਾਣੀ ਬਾਣੀ ਹੈ ਗੁਰੂ ਵਿੱਚ ਬਾਣੀ ਅੰਮ੍ਰਿਤੁ ਸਾਰੇ ਬਾਣੀ ਪੜ੍ਹਨ ਨਾਲ ਮਨ ਸਹਿਜ ਵਿੱਚ ਆ ਜਾਂਦਾ ਹੈ ਅਤੇ ਮਨ ਪ੍ਰਸੰਨ ਰਹਿੰਦਾ ਹੈ ਇਸ ਤੋਂ ਇਲਾਵਾ ਟੀ ਵੀ 'ਤੇ ਇੱਕ ਸ਼ੋਅ ਦਿਖਾਇਆ ਜਾਂਦਾ ਹੈ ਸੋਨੀ ਲੀਵ 'ਤੇ ਦਿਖਾਇਆ ਜਾਣ ਵਾਲਾ ਸ਼ੋਅ ਹੈ ਸ਼ਾਰਕ ਟੈਂਕ ਇੰਡੀਆ ਉਸ ਵਿੱਚ ਨਵੇਂ ਨਵੇਂ ਬਿਜਨਿਸ ਨਵੇਂ ਨਵੇਂ ਸਟਾਰਟਅਪਸ ਆਉਂਦੇ ਹਨ ਜੋ ਕਿ ਦੱਸਦੇ ਹਨ ਕਿ ਸਾਨੂੰ ਇੰਨਾ ਆਪਣਾ ਬਿਜਨਸ ਸਪੈਂਡ ਕਰਨ ਵਾਸਤੇ ਇੰਨਾ ਪੈਸਾ ਚਾਹੀਦਾ ਹੈ ਐਨੇ ਤੁਸੀਂ ਸਾਨੂੰ ਆਪਣਾ ਪੈਸਾ ਲਗਾ ਦਿਓ ਅਤੇ ਅਸੀਂ ਤੁਹਾਨੂੁੰ ਐਨੇ ਪ੍ਰਸੈਂਟ ਸ਼ੇਅਰ ਦੇਵਾਂਗੇ ਅਤੇ ਜਿਹੜਾ ਪ੍ਰੋਫਿਟ ਹੈ ਉਹ ਅਸੀਂ ਆਪਸ ਵਿੱਚ ਵੰਡ ਲਵਾਂਗੇ